ਨਾਗਰਿਕਾਂ ਦੀ ਸੁਰੱਖਿਆ ਅਤੇ ਸਮਾਜ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਕਾਨੂੰਨੀ ਪ੍ਰਣਾਲੀ ਵਿੱਚ ਕਈ ਤਰ੍ਹਾਂ ਦੇ ਸੁਧਾਰ ਕੀਤੇ ਜਾ ਸਕਦੇ ਹਨ ਜਿਵੇਂ ਕਿ ਕਾਨੂੰਨ ਬਣਾਉਣ ਵਾਲਿਆਂ ਅਤੇ ਲੋਕਾਂ ਵਿੱਚ ਇੱਕ ਵਿਸ਼ਵਾਸ ਹੋਣਾ ਚਾਹੀਦਾ ਹੈ ਉਨ੍ਹਾਂ 'ਚ ਇੱਕ ਸੰਚਾਰ ਦਾ ਸਾਧਨ ਵਧੀਆ ਹੋਣਾ ਚਾਹੀਦਾ ਹੈ ਤਾਂ ਕਿ ਲੋਕ ਆਪਣੀ ਗੱਲ ਕਾਨੂੰਨ ਬਣਾਉਣ ਵਾਲਿਆਂ ਅੱਗੇ ਰੱਖ ਸਕਣ ਹੋਰ ਸਮਾਜਿਕ ਕੰਮਾਂ ਸਿੱਖਿਆ ਅਤੇ ਸਕੂਲਾਂ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ ਤਾਂ ਕਿ ਆਪਾਂ ਆਪਣੇ ਸਮਾਜ ਨੂੰ ਇੱਕ ਪੜ੍ਹਿਆ ਲਿਖਿਆ ਸਮਾਜ ਬਣਾ ਸਕੀਏ ਰੁਜ਼ਗਾਰ ਦੇ ਮੌਕੇ ਬਣਾਉਣੇ ਚਾਹੀਦੇ ਹਨ ਤਾਂ ਕਿ ਲੋਕ ਕੰਮਾਂ ਕਾਰਾਂ ਵਾਲੇ ਹੋ ਸਕਣ ਹੋਰ ਸਜ਼ਾ ਦੇਣ ਦੇ ਤਰੀਕਿਆਂ ਵਿੱਚ ਧਿਆਨ ਦੇਣਾ ਚਾਹੀਦਾ ਹੈ ਅਤੇ ਉਹਨਾਂ 'ਚ ਸੁਧਾਰ ਕਰਨਾ ਚਾਹੀਦਾ ਹੈ ਜਿਵੇਂ ਕਿ ਅੱਜ ਕੱਲ੍ਹ ਟੈਕਨੋਲੌਜੀ ਵੱਧ ਰਹੀ ਹੈ ਕਿਸੇ ਜੁਰਮ ਅਤੇ ਉਸਦੀ ਜਾਂਚ ਪੜਤਾਲ ਕਰਨ ਵਿੱਚ ਇਸਦਾ ਇਸਤੇਮਾਲ ਕਰਨਾ ਚਾਹੀਦਾ ਹੈ ਤਾਂ ਕਿ ਨਿਆਂਏ ਜਲਦੀ ਮਿਲ ਸਕੇ ਹੋਰ ਲੋਕਾਂ ਵਿੱਚ ਕਾਨੂੰਨੀ ਜਣ ਜਾਣਕਾਰੀ ਅਤੇ ਸਿੱਖਿਆ ਦੇਣੀ ਚਾਹੀਦੀ ਹੈ ਅਤੇ ਵੱਧਦੀ ਅਪਰਾਧ ਦਰ ਬਾਰੇ ਮੈਂ ਇਹ ਕਹਿਣਾ ਚਾਹੂੰਗਾ ਕਿ ਸਿਰਫ ਸਜ਼ਾ ਦੇਣਾ ਹੀ ਕਾਫੀ ਨਹੀਂ ਉਸ ਮੁੱਦੇ 'ਤੇ ਗੱਲ ਹੋਣੀ ਚਾਹੀਦੀ ਹੈ ਇਹ ਕਿਉਂ ਹੋਇਆ ਸਿਰਫ ਕਾਨੂੰਨ ਸਖ਼ਤ ਕਰਨ ਨਾਲ ਅਪਰਾਧ ਨਹੀਂ ਘੱਟਦੇ ਸਾਨੂੰ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ ਵੀ ਇਹ ਚੀਜ਼ ਗਲਤ ਹੈ ਧੰਨਵਾਦ